ਬਗੀਚੇ ਵਿੱਚ ਆਪਾਂ ਨੂੰ ਬਹੁਤ ਸਾਰੇ ਸੰਦਾਂ ਦੀ ਲੋੜ ਨਹੀਂ ਹੁੰਦੀ ਜਿਹੜੇ ਸੰਦਾਂ ਦੀ ਆਪਾਂ ਨੂੰ ਲੋੜ ਹੁੰਦੀ ਹੈ ਉਹ ਆਪਾਂ ਨੂੰ ਘਰ ਵਿੱਚ ਹੀ ਮਿਲ ਜਾਂਦੇ ਹਨ ਜਿਵੇਂ ਆਪਾਂ ਖੁਰਪੇ ਦੀ ਗੱਲ ਕਰੀਏ ਖੁਰਪੇ ਨਾਲ ਆਪਾਂ ਨੇ ਚੰਗੀ ਤਰ੍ਹਾਂ ਮਿੱਟੀ ਦੀ ਗੁਡਾਈ ਕਰਨੀ ਹੁੰਦੀ ਹੈ ਅਤੇ ਉਸ ਨਾਲ ਚੰਗੀ ਤਰ੍ਹਾਂ ਮਿੱਟੀ ਪੋਲੀ ਹੋ ਜਾਂਦੀ ਹੈ ਬੁ ਉਸ ਤੋਂ ਬਾਅਦ ਅ ਆਪਾਂ ਆਰੀ ਦੀ ਗੱਲ ਕਰੀਏ ਆਰੀ ਨਾਲ ਆਪਾਂ ਨੂੰ ਦਰਖਤ ਦੀਆਂ ਟਾਹਣੀਆਂ ਛਾਂਗਣੀਆਂ ਹੁੰਦੀਆਂ ਹੈ ਉਹਦੇ ਨਾਲ ਆਪਾਂ ਆਰੀ ਨਾਲ ਛਾਂਗ ਲੈਂਦੇ ਹਾਂ ਅਤੇ ਕੁਹਾੜੀ ਨਾਲ ਐਵੇਂ ਐਂ ਵੀ ਜਿਹੜੀ ਆਰੀ ਨਾਲ ਨਹੀਂ ਛਾਂਗ ਹੁੰਦੀਆਂ ਉਹ ਆਪਾਂ ਕੁਹਾੜੀ ਨਾਲ ਵੱਢ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਕਹੀ ਦੀ ਗੱਲ ਕਰੀਏ ਕਹੀ ਨਾਲ਼ ਆਪਾਂ ਨੇ ਜੋ ਮਿੱਟੀ ਹੁੰਦੀ ਹੈ ਮਿੱਟੀ ਨੂੰ ਚੰਗੀ ਤਰ੍ਹਾਂ ਪੱਟ ਕੇ ਉਸਨੂੰ ਚੰਗੀ ਤਰ੍ਹਾਂ ਪਲੇਨ ਕਰਕੇ ਉਸ ਵਿੱਚ ਬੀਜ ਬੀਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਪਾਂ ਖੁਰਪੀ ਦੀ ਗੱਲ ਕਰੀਏ ਖੁਰਪੀ ਨਾਲ ਇੱਦਾਂ ਹੈ ਜਿਵੇਂ ਲਸਣ ਪਿਆਜ਼ ਹੋ ਗਏ ਉਸ ਦੀ ਆਪਾਂ ਨੇ ਗੋਡੀ ਕਰਨੀ ਹੁੰਦੀ ਹੈ